ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਹਾਂਜੀ ਹਾਂਜੀ ਕਰੋ ਠੀਕ ਹੈ ਹਾਂਜੀ ਠੀਕ ਆ ਜੀ ਹਾਂਜੀ ਜੀ ਹਾਂਜੀ ਮੈਮ ਜ਼ਰੂਰ ਪਹੁੰਚਾਵਾਂਗੇ ਤੁਹਾਡੀ ਕੰਪਲੇਂਨ ਨੋਟ ਕਰ ਲਈ ਹੈ ਤੁਹਾਨੂੰ ਇਨਸਾਫ ਮਿਲੇਗਾ ਜ਼ਰੂਰ ਹੋਰ ਕੋਈ ਸਮੱਸਿਆ ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ ਹਾਂਜੀ

ਹਾਂਜੀ ਠੀਕ ਆ ਮੈਮ ਕੋਈ ਨਹੀਂ ਚੈੱਕ ਕਰ ਲਵਾਂਗੇ ਕੋਈ ਨਹੀਂ ਕੋਈ ਨਹੀਂ ਇਨਸਾਫ ਦਵਾਵਾਂਗੇ ਤੁਹਾਨੂੰ ਤੁਹਾਡੀ ਮੀਡੀਆ 'ਚ ਖਬਰ ਲਗ ਲਗਾ ਦਾਂਗੇ ਹਾਂਜੀ ਓਕੇ ਜੀ